ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਤਾਂ ਤੁਸੀਂ ਕਿੰਨੇ ਬੰਦਿਆਂ ਵਾਸਤੇ ਲਾਉਣਾ ਜੀ ਲੰਗਰ ਠੀਕ ਹੈ ਜੀ ਇੱਕ ਜਿਹੜਾ ਤੁਸੀਂ ਰਸਦ ਦਾ ਸਾਨੂੰ ਅਸੀਂ ਆਪਣੇ ਵੱਲੋਂ ਲਾਈਏ ਜਾਂ ਤੁਸੀਂ ਲਿਆ ਕੇ ਦਿਓਗੇ ਸਾਨੂੰ ਹਾਂਜੀ ਕੋਈ ਨਾ ਕੋਈ ਨਾ ਕੋਈ ਨਾ ਤਿਆਰ ਅਸੀਂ ਕਰਵਾ ਦਾਂਗੇ ਜੀ ਇੱਥੋਂ ਸਾਡੇ ਆਪਣੇ ਲੰਗਰ ਤਿਆਰ ਹੁੰਦਾ ਹੀ ਹੈ ਲਾਂਗਰੀਆਂ ਤੋਂ ਕਰਵਾ ਦਾਂਗੇ ਤਿਆਰ ਸਾਡੇ ਕੋਲ ਸਾਰੀ ਸਹੂਲਤ ਹੈਗੀ ਹੈ ਸਾਰੇ ਤਰ੍ਹਾਂ ਦੇ ਬਰਤਨ ਹੈਗੇ ਸਾਰਾ ਸਿਸਟਮ ਹੈਗਾ ਪੂਰਾ ਕੋਈ ਨਾ ਅਸੀਂ ਕਰ ਦਾਂਗੇ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਹਜ਼ਾਰ ਬੰਦੇ ਵਾਸਤੇ ਜੋ ਸਮਾਨ ਲੱਗੇਗਾ ਜਿਵੇਂ ਤੁਸੀਂ ਬ੍ਰੈਡ ਪਕੌੜਾ ਕਿਹਾ ਬ੍ਰੈਡ ਦੇ ਤੁਸੀਂ ਲਿਆ ਦਿਉ ਸਾਨੂੰ ਹਜ਼ਾਰ ਬੰਦਿਆਂ ਦੇ ਹਿਸਾਬ ਨਾਲ ਬਰੈਡ ਲਿਆ ਦਿਉ ਪੰਜ ਸੌ ਕੁ ਬਰੈਡ ਲਿਆ ਦਿਉ ਅਤੇ ਉਹਦੇ ਵਿੱਚ ਜਿਹੜਾ ਸਮਾਨ ਪਾਉਣਾ ਹਾਂਜੀ ਹਾਂਜੀ ਪੰਜ ਸੌ ਬਰੈਡ ਅਤੇ ਇਸ ਦੇ ਵਿੱਚ ਤੁਸੀਂ ਜਿਹੜਾ ਅੰਦਰ ਫਿਲਰ ਮਟੀਰੀਅਲ ਭਰਨਾ ਉਹ ਵੀ ਲਿਆ ਦਿਉ ਸਾਨੂੰ ਆਲੂ ਵਗੈਰਾ ਜਾਂ ਹੋਰ ਜਿਹੜੀ ਪਾਉਣੀ ਵਿੱਚ ਜਿਹੜੇ ਮਰਜ਼ੀ ਲਿਆ ਦਿਉ ਇੱਕ ਦੁੱਧ ਲਿਆ ਦਿਉ ਸਾਨੂੰ ਚਾਹ ਵਾਸਤੇ ਹਾਂ ਇੱਕ ਰਿਫਾਇਡ ਓਇਲ ਹਾਂ ਹਾਂ ਠੀਕ ਹੈ ਕੋਈ ਨਾ ਹੋ ਜੂਗਾ ਜੀ ਤੁਹਾਡਾ ਸਾਰਾ ਹੋਜੂ ਤਿਆਰ ਚਿੰਤਾ ਨਾ ਕਰੋ ਤੁਸੀਂ ਹਾਂਜੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਫੇਰ